ਸਾਡੇ ਪੰਜਾਬ ਵਿੱਚ ਪੰਜਾਬ ਦੇ ਲੋਕ ਆਪਣੇ ਸੱਭਿਆਚਾਰਕ ਵਿਰਾਸਤ ਨੂੰ ਬਹੁਤ ਹੀ ਅਨੋਖੇ ਢੰਗ ਨਾਲ ਮਨਾਉਂਦੇ ਹਨ ਅਤੇ ਬਹੁਤ ਹੀ ਖੁਸ਼ੀਆਂ ਭਰਿਆ ਮਾਹੌਲ ਹੁੰਦਾ ਹੈ ਅਤੇ ਸਰਹਿੰਦ ਵਿੱਚ ਇਹ ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਇੱਥੇ ਉੱਥੇ ਕੁੜੀਆਂ ਪਿੱਪਲਾਂ ਨੂੰ ਪਾ ਕੇ ਪੀਂਘਾਂ ਪਾ ਕੇ ਝੂਟਦੀਆਂ ਹਨ ਅਤੇ ਗਿੱਧੇ ਪਾਉਂਦੀਆਂ ਹਨ ਅਤੇ ਮਹਿੰਦੀਆਂ ਲਾਉਂਦੀਆਂ ਹਨ ਅਤੇ ਬਹੁਤ ਹੀ ਖੁਸ਼ ਖੁਸ਼ੀਆਂ ਮਨਾਉਂਦੀਆਂ ਹਨ ਅਤੇ ਉੱਥੇ ਬਹੁਤ ਹੀ ਲੋਕ ਦੇਖਣ ਜਾਂਦੇ ਹਨ ਤੀਆਂ ਦਾ ਮੇਲਾ